ਹਾਂ ਸਿਲਾਈ ਬੁਣਾਈ ਮੇਰੇ ਲਈ ਇੱਕ ਰੁਝਾਨ ਹੈ ਮੈਂ ਇਸ ਨੂੰ ਆਪਣਾ ਇੱਕ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਅਤੇ ਆਪਣੇ ਰੋਜ਼ ਦਾ ਕੰਮ ਵੀ ਇਹਦੇ ਦੇ ਸਹਾਰੇ ਕਰਦੀ ਹਾਂ ਮੈਂ ਸਿਲਾਈ ਬੁਣਾਈ ਸਭ ਕੁਝ ਕਰਦੀ ਹਾਂ ਅਤੇ ਆਪਣੇ ਕਸਟਮਰਾਂ ਨੂੰ ਵੀ ਸਭ ਕੁਛ ਬਣਾ ਕੇ ਦਿੰਦੀ ਹਾਂ ਮੈਂ ਇਹਦੇ 'ਤੇ ਬੁਣਾਈ ਦੇ ਵਿੱਚ ਆਪਣੇ ਠਾਕੁਰ ਜੀ ਦੇ ਬਸਤਰ ਬਣਾਉਂਦੀ ਹਾਂ ਭਗਵਾਨਾਂ ਦੇ ਕੱਪੜੇ ਵੀ ਬਣਾਉਂਦੀ ਹਾਂ ਅਤੇ ਰੋਜ਼ ਰੋਜ਼ ਇਹ ਕੰਮ ਮੈਂ ਆਪਣਾ ਰੋਜ਼ਮੱਰਾ ਦੇ ਕੰਮ ਵਿੱਚ ਮੰਨਿਆ ਹੋਇਆ ਹੈ ਆਪਣੀ ਕਮਾਈ ਦਾ ਇੱਕ ਸਾਧਨ ਬਣਾਇਆ ਹੋਇਆ ਹੈ ਮੈਂ ਇਸ ਨੂੰ ਅਤੇ ਮੈਂ ਦੁਕਾਨਾਂ 'ਤੇ ਵੇਚਣ ਵੀ ਜਾਂਦੀ ਹਾਂ ਇਸ ਨੂੰ ਆਪਣੀ ਬੁਣਾਈ ਮੈਂ ਕਰੋਸ਼ੀਏ ਦਾ ਕੰਮ ਕਰਕੇ ਠਾਕੁਰ ਜੀ ਦੇ ਬਸਤਰ ਬਣਾਉਂਦੀ ਹਾਂ ਭਗਵਾਨਾਂ ਦੇ ਬਸਤਰ ਬਣਾਉਂਦੀ ਹਾਂ ਛੋਟੇ ਬੱਚਿਆਂ ਦੇ ਵੀ ਬਸਤਰ ਬਣਾ ਕੇ ਦੁਕਾਨਾਂ 'ਤੇ ਸੇਲ ਕਰਨ ਜਾਂਦੀ ਹਾਂ ਅਤੇ ਆਪਣਾ ਸਾਧਨ ਕਮਾਈ ਦਾ ਇਹਨੂੰ ਮੈਂ ਬਣਾਇਆ ਹੋਇਆ ਜਿਸ ਨਾਲ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਸੋਹਣੇ ਢੰਗ ਨਾਲ ਹੁੰਦਾ ਹੈ ਅਤੇ ਤੁਸੀਂ ਮੇਰੇ ਕੋਲੋਂ ਇਹ ਕੰਮ ਕਰਵਾ ਵੀ ਸਕਦੇ ਹੋ ਸਾਰੇ ਜਣੇ ਮੈਂ ਬਹੁਤ ਇਹ ਕੰਮ ਕਰਦੀ ਹਾਂ ਹਾਂਜੀ ਅਤੇ ਮੈਨੂੰ ਅੱਛੀ ਖਾਸੀ ਕਮਾਈ ਹੋ ਜਾਂਦੀ ਹੈ ਇਹਦੇ ਵਿੱਚ ਸਾਰਾ ਕੁਛ ਮੇਰਾ ਘਰ ਦਾ ਖ਼ਰਚਾ ਵੀ ਨਿਕਲ ਜਾਂਦਾ ਹੈ ਅਤੇ ਮੈਂ ਆਪਣਾ ਰੋਜ਼ ਦਾ ਖ਼ਰਚਾ ਇਹਦੇ ਵਿੱਚੋਂ ਕੱਢਦੀ ਹਾਂ ਆਪਣੇ ਬੱਚਿਆਂ ਦਾ ਵੀ ਖ਼ਰਚਾ ਇਹਦੇ ਵਿੱਚੋਂ ਕੱਢ ਲੈਂਦੀ ਹਾਂ ਅਤੇ ਮੈਨੂੰ ਇਹਦੀ ਲੋੜ ਵੀ ਪੈਂਦੀ ਰਹਿੰਦੀ ਹੈ ਇਸ ਲਈ ਮੈਂ ਬੁਣਾਈ ਨੂੰ ਆਪਣਾ ਇੱਕ ਰੁਝਾਨ ਬਣਾਇਆ ਹੋਇਆ ਹੈ